ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਮੈਂ ਅਭਿਸ਼ੇਕ ਬੋਲ ਰਿਹਾ ਰੋਪੜ ਤੋਂ ਮੈਂ ਕੇਕ ਓਡਰ ਕੀਤਾ ਹੋਇਆ ਸੀਗਾ ਅਤੇ ਹੁਣ ਤੱਕ ਤੁਹਾਡਾ ਓਡਰ ਨਹੀਂ ਪਹੁੰਚਿਆ ਹੈਗਾ ਸੱਤ ਵਜੇ ਦਾ ਓਡਰ ਕੀਤਾ ਹੋਇਆ ਸੀਗਾ ਅਤੇ ਹੁਣ ਦੇਖ ਲਉ ਦਸ ਵੱਜ ਚੁੱਕੇ ਨੇ ਮੇਰੇ ਰਿਸ਼ਤੇਦਾਰ ਆਏ ਹੋਏ ਨੇ ਅਤੇ ਕਿੰਨਾ ਟਾਈਮ ਖਰਾਬ ਹੋ ਹੋ ਰਿਹਾ ਮੇਰੀ ਅਤੇ ਤੁਹਾਡਾ ਕੰਮ ਇੰਨਾ ਜ਼ਿਆਦਾ ਢਿੱਲਾ ਹੈ ਤਾਂ ਅੱਗੇ ਤੋਂ ਮੈਂ ਕਿਸੇ ਹੋਰ ਪਾਸੇ ਤੋਂ ਓਡਰ ਕਰਵਾ ਲੈਣਾ ਕਿਉਂ ਤੁਸੀਂ ਇੰਨਾ ਮੇਰਾ ਟਾਈਮ ਖਰਾਬ ਕਰ ਰਹੇ ਹੋ ਜਲਦੀ ਤੋਂ ਜਲਦੀ ਓਡਰ ਭੇਜ ਦਿਉ ਹੱਥ ਜੋੜ ਕੇ ਬੇਨਤੀ ਓ ਆ